ਮੈਂ ਨਵਾਂ ਸ਼ਹਿਰ ਦੀ ਰਹਿਣ ਵਾਲੀ ਹਾਂ ਚ ਅਤੇ ਇੱਥੇ ਮਤਲਬ ਕਿ ਭਗਤ ਭਗਤ ਸਿੰਘ ਦਾ ਘਰ ਆ ਮਿਊਜ਼ੀਅਮ ਆ ਅਤੇ ਪਾਰਕ ਆ ਅਤੇ ਕਾਫੀ ਸਾਰੇ ਗੁਰਦੁਆਰੇ ਹੈ ਅਤੇ ਜੋ ਵੀ ਮਤਲਬ ਬਾਹਰ ਬਾਹਰ ਤੋਂ ਆਉਂਦੇ ਹੈ ਨਾ ਉਹਨਾਂ ਲਈ ਮਤਲਬ ਕਿ ਉਹਨਾਂ ਲਈ ਖਾਣ ਪੀਣ ਦਾ ਪ੍ਰਬੰਧ ਜਾਂ ਫਿਰ ਮਤਲਬ ਕਿ ਰਹਿਣ ਸਹਿਣ ਦਾ ਹਰ ਇੱਕ ਚੀਜ਼ ਮਤਲਬ ਵਧੀਆ ਆ ਅਤੇ ਸੈਲਾ ਸੈਲਾਨੀਆਂ ਨੂੰ ਆਕਰਸ਼ਿਤ ਕਰਨ ਲਈ ਜਿੱਦਾਂ ਮਤਲਬ ਕਿ ਮੈਂ ਇਹਦੀ ਗੱਲ ਕਰਾਂ ਤਾਂ ਮਤਲਬ ਜਿਹੜੇ ਬਾਹਰ ਤੋਂ ਲੋਕ ਆਉਂਦੇ ਆ ਮਤਲਬ ਸਰਕਾਰ ਦੇ ਜੇ ਸਰਕਾਰ ਨੂੰ ਉਹਨਾਂ ਦੀ ਟਿਕਟ ਆ ਮਤਲਬ ਫਰੀ ਕਰ ਫਰੀ ਹੋਣੀ ਚਾਹੀਦੀ ਆ ਅਤੇ ਉਹਨਾਂ ਤੋਂ ਟੈਕਸ ਟੈਕਸ ਟੈਕਸ ਜਿਹੜਾ ਉਹ ਘੱਟ ਲੈਣਾ ਚਾਹੀਦਾ ਆ ਹੈ ਨਾ ਅਤੇ ਉਹਨਾਂ ਦਾ ਜਿਹੜਾ ਮਤਲਬ ਸਵਾਗਤ ਹੈ ਉਹ ਕਾਫੀ ਵਧੀਆ ਤਰੀਕੇ ਨਾਲ ਕਰਨਾ ਚਾਹੀਦਾ ਆ ਕਿਉਂਕਿ ਉਹ ਮਤਲਬ ਬਾਹਰ ਤੋਂ ਆਏ ਹੋਏ ਆ